ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਟੋਮੈਟਿਕ ਭੁਗਤਾਨ ਸਥਾਪਿਤ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਯੂਟੀਲਿਟੀ ਪ੍ਰਧਤਾ ਦੀ ਵੈਬਸਾਈਟ 'ਤੇ ਜਾਓ ਆਪਣੇ ਪਾਣੀ ਅਤੇ ਯੂਟੀਲਿਟੀ ਪ੍ਰਾਂਤਾਂ ਦੀ ਆਧਾਰਿਕ ਵੈਬਸਾਈਟ 'ਤੇ ਜਾਓਗੇ ਤਾਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਖਾਤਾ ਲੋਗਿਨ ਕਰੋ ਖਾਤਾ ਨਵਾਂ ਬਣਾਓ ਅਤੇ ਉਸਨੂੰ ਲੋਗਿਨ ਕਰੋ ਜੇ ਤੁਹਾਡੇ ਕੋਲ ਖਾਤਾ ਨਹੀਂ ਹੈ ਤਾਂ ਇੱਕ ਖਾਤਾ ਬਣਾਓ ਜੇ ਤੁਹਾਡੇ ਕੋਲ ਪਹਿਲਾਂ ਤੋਂ ਖਾਤਾ ਹੈ ਤਾਂ ਆਪਣੇ ਪ੍ਰਮਾਣ ਪੱਤਰਾਂ ਦੇ ਨਾਲ ਲੋਗਇਨ ਕਰੋ ਉਸ ਤੋਂ ਬਾਅਦ ਭੁਗਤਾਨ ਵਿਕਲਪਾਂ 'ਤੇ ਜਾਓ ਭੁਗਤਾਨ ਵਿਕਲਪਾਂ ਦੇ ਵਿੱਚ ਤੁਸੀਂ ਬਿਲਿੰਗ ਜਾਂ ਭੁਗਤਾਨ ਵਿਕਲਪਾਂ ਦੇ ਨਾਲ ਸੰਬੰਧਿਤ ਸ਼ਿਕਸ਼ਣ ਨੂੰ ਲੱਭੋ ਉਸ ਤੋਂ ਬਾਅਦ ਅਟੋਮਿਕ ਭੁਗਤਾਨ ਨੂੰ ਚੁਣੋ ਆਟੋਮੈਟਿਕ ਭੁਗਤਾਨ ਨੂੰ ਚੁਣੋ ਉਸ ਤੋਂ ਬਾਅਦ ਤੁਸੀਂ ਜਾਓਗੇ ਬੈਂਕ ਜਾਣਕਾਰੀ ਇਹ ਤੁਹਾਨੂੰ ਤੁਹਾਡੇ ਬੈਂਕ ਦੇ ਰਿਲੇਟਡ ਬਹੁਤ ਸਾਰੀ ਜਾਣਕਾਰੀ ਦੇਣਗੇ ਜਿਵੇਂ ਕਿ ਬੈਂਕ ਖਾਤੇ ਦੇ ਵੇਰਵੇ ਜਾਂ ਰੈਵ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਪੁਸ਼ਟੀ ਕਰੋ ਅਤੇ ਫਿਰ ਸੇਵ ਕਰੋ ਇਹ ਸਾਰੀਆਂ ਚੀਜ਼ਾਂ ਦੀ ਤੁਸੀਂ ਪੁਸ਼ਟੀ ਕਰੋਗੇ ਅਤੇ ਉਸ ਤੋਂ ਬਾਅਦ ਸੇਵ ਕਰੋ